ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਾਡਾ ਔਰਗੈਨਿਕ ਫਾ ਓ ਹੈਗੀ ਆ ਜਮੀਨ ਹੈਗੀ ਆ ਅਤੇ ਅਸੀਂ ਉਸ 'ਤੇ ਔਰਗੈਨਿਕ ਚੀਜ਼ਾਂ ਬਣਦੀਆਂ ਹੈਗੀਆਂ ਅਤੇ ਫਿਰ ਅੱਗੇ ਔਰਗੈਨਿਕ ਹੀ ਉਹਨਾਂ ਨੂੰ ਵੇਚ ਦਿੰਦੇ ਹੈਗੇ ਹਾਂ ਅਤੇ ਸਾਡੇ ਕੋਲ ਵੱਖਰੇ ਵੱਖਰੇ ਤਰ੍ਹਾਂ ਦੇ ਜਿੱਦਾਂ ਪ੍ਰੋਡਕਟਸ ਹੈਗੇ ਨੇ ਅਤੇ ਫਿਰ ਆਪਾਂ ਉਹ ਵੇਚਦੇ ਹਾਂ ਜਿਹਦੇ ਵਿੱਚ ਸਾਡਾ ਸਭ ਤੋਂ ਲਾਈਕ ਜਿਹਨੂੰ ਆਪਾਂ ਕਹਿੰਦੇ ਹਾਂ ਸਭ ਤੋਂ ਵਿਕਣ ਵਾਲਾ ਹੈਗਾ ਪ੍ਰੋਡਕਟ ਜਿਹੜਾ ਹੈਗਾ ਉਹ ਜਿਹਨੂੰ ਆਪਾਂ ਗੁੜ ਕਹਿੰਦੇ ਹੈਗੇ ਹਾਂ ਉਹ ਹੈਗੇ ਕਿਉਂਕਿ ਆਪਾਂ ਆਪਣੀ ਗੰਨੇ ਉਗਾ ਕੇ ਉਹਨਾਂ ਦਾ ਗੁ ਗੁੜ ਕੱਢਦੇ ਜਿਹੜਾ ਕਿ ਸਭ ਤੋਂ ਜ਼ਿਆਦਾ ਵਧੀਆ ਅਤੇ ਸਾਡਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਪ੍ਰੋਡਕਟ ਹੈਗਾ ਹੈ ਅਤੇ ਉਸ ਤੋਂ ਬਾਅਦ ਸਾਡਾ ਜਿਹੜਾ ਕਹਿੰਦੇ ਨੇ ਸਰਸੋਂ ਦਾ ਤੇਲ ਹੈਗਾ ਵਾ ਅਤੇ ਉਹ ਅਸੀਂ ਵੇਚਦੇ ਹੈਗੇ ਹਾਂ ਅਤੇ ਹੋਰ ਵੀ ਹੈਗੇ ਆ ਨਾਰੀਅਲ ਦਾ ਤੇਲ ਹੈਗਾ ਇਹ ਆਪਾਂ ਹਾਂ ਉਹ ਵੀ ਚੀਜ਼ ਹੈਗੀ ਆ ਆਪਣੇ ਕੋਲ ਅਤੇ ਹਨੀ ਵੀ ਆਪਾਂ ਉਗਾਉਂਦੇ ਹੈਗੇ ਹਾਂ ਬਟ ਆਪਾਂ ਉਹ ਚੀਜ਼ ਵੀ ਹਾਂਜੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਸਾਡੇ ਕੋਲ ਔਰਗੈਨਿਕ ਹਨੀ ਹੁੰਦੀ ਹੈਗੀ ਹੈ ਅਤੇ ਉਹ ਵੀ ਆਪਾਂ ਉਗਾਈ ਦੀ ਹੈ ਅਤੇ ਉਹਦਾ ਮੈਂ ਤੁਹਾਨੂੰ ਰੇਟ ਦੱਸ ਦਿੰਦਾ ਉਹਦਾ ਰੇਟ ਹੁੰਦਾ ਜੀ ਜਿਹਨੂੰ ਆਪਾਂ ਕੀ ਕਹਿੰਦੇ ਨੇ ਪੰਜ ਸੌ ਰੁਪਏ ਲੀਟਰ ਹੁੰਦਾ ਹੈਗਾ

ਨਹੀਂ ਨਹੀਂ ਸਾਡੀ ਕੋਈ ਵੈਬਸਾਈਡ ਵੁਵਸਾਈਡ ਨਹੀਂ ਸਾਡੇ ਇੱਥੇ ਹੀ ਆ ਕੇ ਲੈਂਦੇ ਨੇ ਹਾਂਜੀ ਤੁਸੀਂ ਨਾ ਤੁਸੀਂ ਸਾਡੇ ਤੋਂ ਆ ਕੀ ਕਹਿੰਦੇ ਗੁੜ ਅਤੇ ਇਹ ਮਸਟਰਡ ਆਇਲ ਜ਼ਰੂਰ ਲੈ ਕੇ ਉਹ ਸਾਡਾ ਬੜਾ ਵਿਕਦਾ ਹੈਗਾ ਹੈ

ਜੇ ਤੁਸੀਂ ਆਪਣਾ ਕੀ ਕਹਿੰਦੇ ਨੇ ਗੁੜ ਦਾ ਰੇਟ ਪੁੱਛਣਾ ਤਾਂ ਉਹ ਤੁਸੀਂ ਪੁੱਛ ਸਕਦੇ ਹੋ ਫਿਰ ਮੈਂ ਤੁਹਾਨੂੰ ਉਹ ਗੁੜ ਦਾ ਰੇਟ ਦਾ ਰੇਟ ਹੈ ਨਾ ਉਹ ਪੰਜ ਸੌ ਰੁਪਏ ਕਿਲੋ ਹੈਗਾ ਸ਼ੁੱਧ ਦੇਸੀ ਸੁੰਡਾਂ ਵਾਲਾ ਗੁੜ ਹੈਗਾ ਹੈ ਜਿਹੜਾ ਕਿ ਪੰਜਾਬੀ ਦੀਆਂ ਬਹੁਤ ਜ਼ਿਆਦਾ ਚੱਲਦਾ ਹੈਗਾ ਤੁਸੀਂ ਹਾਂਜੀ ਨਹੀਂ ਉਹ ਸਾਡੇ ਪ੍ਰਾਈਜ਼ ਜ ਜ ਜ਼ਿਆਦਾ ਜ਼ਰੂਰ ਹੋਣਗੇ ਬਟ ਸਾਡੀ ਜਿਹੜੀ ਕੁਆਲਿਟੀ ਹੈਗੀ ਆ ਨਾ ਉਹ ਤੁਹਾਨੂੰ ਮਾਰਕੀਟ 'ਚ ਕਿਤੇ ਨਹੀਂ ਮਿਲਣੀ ਕਿਉਂਕਿ ਆਪਾਂ ਇੱਕ ਵੀ ਪਰਸੈਂਟ ਨਾ ਖਾਣ ਪੀਣ 'ਤੇ ਕੰਪਰੋਮਾਈਜ਼ ਨਹੀਂ ਕਰਦੇ ਬਾਕੀ ਕੰਪਨੀ ਦੀ ਕਰਦੀਆਂ ਪੈਸਾ ਬਚਾਉਣ ਵਾਸਤੇ ਉਹ ਘਟੀਆ ਮਟੀਰੀਅਲ ਯੂਜ਼ ਕਰ ਲੈਂਦੀਆਂ ਹੈਗੀਆਂ ਇੱਦਾਂ ਹੀ ਜਿੱਦਾਂ ਸਾਡਾ ਹਾਂ ਹਾਂ ਤੁਸੀਂ ਸਾਡੇ ਫਾਰਮ ਹਾਊਸ 'ਤੇ ਆਓ ਤੁਹਾਨੂੰ ਪੂਰਾ ਸਾਡਾ ਆਪਾਂ ਕੰਮ ਦਿਖਾਵਾਂਗੇ ਇਕ ਆਹ ਸਾਡਾ ਮਸਟਰਡ ਆਇਲ ਵੀ ਬੜਾ ਮਸ਼ਹੂਰ ਹੈਗਾ ਸੀ ਉਹ ਵੀ ਟਰਾਈ ਕਰਕੇ ਜ਼ਰੂਰ ਦੇਖਣਾ ਤੁਸੀਂ ਸਾਡੇ ਸਾਡਾ ਮਸਟਡ ਓਇਲ ਇੰਨਾ ਵਧੀਆ ਕਿ ਤੁਸੀਂ ਉਹਨੂੰ ਸਬਜ਼ੀ ਉਹਦਾ ਹੈਗਾ ਪ੍ਰਾਈਜ਼ ਸੱਤ ਸੌ ਰੁਪਏ ਲੀਟਰ ਹੈਗਾ ਉਹਦਾ ਪ੍ਰਾਈਜ਼ ਹਾਂਜੀ ਜੀ ਉਹ ਵੀ ਪੂਰਾ ਅਸੀਂ ਪੂਰਾ ਅਸੀਂ ਨ ਮਤਲਬ ਔਰਗੈਨਿਕਲੀ ਉਹ ਸਾਰਾ ਕੱਢਦੇ ਹਾਂ ਕੋਈ ਨਹੀਂ ਬਾਕੀ ਤੁਸੀਂ ਸਾਡੇ ਫੋਰਮ ਹਾਊਸ 'ਤੇ ਆਓ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਵਾਂਗੇ ਅਤੇ ਨਾਲੇ ਤੁਹਾਨੂੰ ਪਤਾ ਲੱਗ ਜਾਏਗਾ

ਚਲੋ ਠੀਕ ਹੈ ਜੀ ਅਤੇ ਧੰਨਵਾਦ